ਭਾਰਤ ਵਿਚ ਤਿੰਨ ਪ੍ਰਕਾਰ ਦੇ ਮੌਸਮ ਪਾਏ ਜਾਂਦੇ ਹਨ ਗਰਮੀ ਸਰਦੀ ਅਤੇ ਬਰਸਾਤ ਜੇਕਰ ਅਸੀਂ ਭਾਰਤ ਦੇ ਨੌਰਥ ਵਾਲੇ ਖੇਤਰ ਪੰਜਾਬ ਵੱਲ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਨਾ ਹੀ ਜ਼ਿਆਦਾ ਠੰਡਾ ਅਤੇ ਨਾ ਹੀ ਜ਼ਿਆਦਾ ਗਰਮ ਰਹਿੰਦਾ ਹੈ ਸਰਦੀਆਂ ਵਿੱਚ ਉੱਥੇ ਗੂੜ੍ਹੀ ਠੰਡ ਹੁੰਦੀ ਹੈ ਅਤੇ ਗਰਮੀਆਂ ਵਿਚ ਉੱਥੇ ਗਰਮੀ ਹੁੰਦੀ ਹੈ ਬਰਸਾਤ ਦਾ ਮੌਸਮ ਵੀ ਠੀਕ ਠਾਕ ਹੀ ਰਹਿੰਦਾ ਹੈ ਪਰ ਜੇ ਅਸੀਂ ਹਿਮਾਚਲ ਸਾਈਡ ਦੇਖੀਏ ਤਾਂ ਉਹ ਜ਼ਿਆਦਾਤਰ ਠੰਡਾ ਰਹਿੰਦਾ ਹੈ ਤਾਂ ਹੀ ਹਿਮਾਚਲ ਸਾਈਡ ਸ਼ਿਮਲਾ ਨੈਨੀਤਾਲ ਮੈਕਲੋਡਗੰਜ ਵਰਗੇ ਸ਼ਹਿਰ ਜਿਹੜੇ ਹਨ ਉਹ ਬਹੁਤ ਜ਼ਿਆਦਾ ਠੰਡੇ ਰਹਿੰਦੇ ਹਨ ਕਿਉਂਕਿ ਉੱਥੇ ਬਰਫ਼ ਪਾਈ ਜਾਂਦੀ ਹੈ ਉੱਥੇ ਜ਼ਿਆਦਾਤਰ ਪਹਾੜੀ ਇਲਾਕਾ ਹੈ ਜੋ ਕਿ ਹਿਮਾਚਲ ਨੂੰ ਠੰਡਾ ਰੱਖਦਾ ਹਨ ਅਤੇ ਜੇ ਹੁਣ ਅਸੀਂ ਇੰਡੀਆ ਦੇ ਕੇਰਲਾ ਸਾਈਡ ਦੇਖੀਏ ਕੇਰਲਾ ਮੇਘਾਲਿਆ ਰਾਜਸਥਾਨ ਉਹ ਸਾਰੇ ਇਲਾਕੇ ਜ਼ਿਆਦਾਤਰ ਗਰਮ ਹੀ ਪਾਏ ਜਾਂਦੇ ਹਨ ਕਿਉਂਕਿ ਨਾ ਹੀ ਉੱਥੇ ਜ਼ਿਆਦਾ ਬਾਰਿਸ਼ਾਂ ਦਾ ਸਾਧਨ ਹੈ ਅਤੇ ਨਾ ਹੀ ਉੱਥੇ ਪਹਾੜ ਹਨ ਉਹਨਾਂ ਇਲਾਕਿਆਂ ਵਿੱਚ ਜ਼ਿਆਦਾਤਰ ਗਰਮੀ ਪਾਈ ਜਾਂਦੀ ਹੈ